ਪੱਗ ਦੀ ਚਾਹੇ ਕੋਈ ਵੀ ਕਿਸਮ ਹੋਵੇ ਹਰ ਕਿਸਮ ਦੀ ਪੱਗ ਦੀ ਇੱਕੋ ਹੀ ਮਹੱਤਤਾ ਹੈ ਕਿ ਪੱਗ ਅਣਖ ਅਤੇ ਸਰਦਾਰੀ ਦਾ ਪ੍ਰਤੀਕ ਹੈ ਪੱਗ ਸਿੱਖਾਂ ਦੀ ਪਹਿਚਾਣ ਅਤੇ ਸਿੱਖ ਪੱਗ ਨੂੰ ਆਪਣੀ ਸ਼ਾਨ ਮੰਨਦੇ ਹਨ ਸਿੱਖਾਂ ਵੱਲੋਂ ਬੰਨ੍ਹੀ ਜਾਂਦੀ ਪੱਗ ਦੀ ਸਾਰੀ ਦੁਨੀਆਂ ਵਿੱਚ ਧੂਮਾਂ ਹਨ ਅਤੇ ਹਰ ਦੇਸ਼ ਵਿਦੇਸ਼ ਵਿੱਚ ਪੱਗ ਨੂੰ ਬਹੁਤ ਮਾਣ ਅਤੇ ਸਤਿਕਾਰ ਮਿਲਦਾ ਹੈ ਦਸਤਾਰਧਾਰੀ ਵਿਅਕਤੀ ਦੀ ਹਰ ਕੋਈ ਇੱਜ਼ਤ ਕਰਦਾ ਹੈ ਹਰ ਇੱਕ ਵਿਅਕਤੀ ਦਾ ਪੱਗ ਬੰਨ੍ਹਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਅਤੇ ਖਾਸ ਮੌਕਿਆਂ 'ਤੇ ਕੁਝ ਖਾਸ ਤਰੀਕੇ ਦੀਆਂ ਪੱਗਾਂ ਬੰਨ੍ਹੀਆਂ ਜਾਂਦੀਆਂ ਹਨ ਜਿਵੇਂ ਕਿ ਪੋਚਮੀ ਪੱਗ ਅੱਜ ਕੱਲ੍ਹ ਇਹ ਨੌਜਵਾਨ ਉਮਰ ਦੇ ਮੁੰਡੇ ਬੰਨ੍ਹਦੇ ਹਨ ਇਸ ਪੱਗ ਦਾ ਹਰ ਪੇਚ ਪੂਰੀ ਤਰਾਂ ਸਾਫ਼ ਹੁੰਦਾ ਹੈ ਇਸ ਦੀ ਪੂਣੀ ਖਾਸ ਤਰੀਕੇ ਨਾਲ ਬਹੁਤ ਹੀ ਸਫ਼ਾਈ ਨਾਲ ਕੀਤੀ ਜਾਂਦੀ ਹੈ ਪੱਗ ਦੀ ਬਣਤਰ ਸਿਰ ਵਾਲੇ ਪਾਸਿਓਂ ਇੱਕੋ ਜਿਹੀ ਹੁੰਦੀ ਹੈ ਅਤੇ ਇਸ ਦੇ ਉੱਪਰ ਵਾਲੇ ਪੇਚ ਵੀ ਪੂਰੀ ਤਰਾਂ ਸਾਫ਼ ਅਤੇ ਇੱਕ ਬਰਾਬਰ ਹੁੰਦੇ ਹਨ ਪਟਿਆਲਾ ਸ਼ਾਹੀ ਪੱਗ ਇਸ ਪੱਗ ਦੀ ਬਣਤਰ ਸੱਜਿਓਂ ਪਾਸਿਓਂ ਨੀਵੀਂ ਅਤੇ ਖੱਬੇ ਪਾਸਿਓਂ ਉੱਚੀ ਹੁੰਦੀ ਹੈ ਇਸ ਪੱਗ ਵਿੱਚ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਇਸ ਪੱਗ ਦੀ ਬਣਤਰ ਸਿਰ ਦੇ ਉੱਪਰੀ ਪਾਸਿਓਂ ਇੱਕੋ ਜਿਹੀ ਨਹੀਂ ਹੁੰਦੀ ਅਤੇ ਇਸ ਪੱਗ ਦੇ ਸੱਜੇ ਪਾਸੇ ਵਾਲੇ ਪੇਚਾਂ ਵਿੱਚ ਵਿੱਥ ਰੱਖੀ ਜਾਂਦੀ ਹੈ ਇਸ ਪੱਗ 'ਤੇ ਅੱਜ ਕੱਲ੍ਹ ਬਹੁਤ ਗੀਤ ਬਣ ਰਹੇ ਹਨ ਇਸ ਤੋਂ ਇਲਾਵਾ ਹੋਰ ਵੀ ਪੱਗਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਜਿਵੇਂ ਵੱਟਾਂ ਵਾਲੀ ਪੱਗ ਯੂ ਕੇ ਸਟਾਈਲ ਪੱਗ ਮਲਵਈ ਪੱਗ ਤੁਰਲੇ ਵਾਲੀ ਪੱਗ ਭੰਗੜੇ ਵਾਲੀ ਪੱਗ ਆਦਿ ਪਰ ਮੇਰੀ ਜੋ ਪਸੰਦੀਦਾ ਸਟਾਈਲ ਹੈ ਉਹ ਹੈ ਮਲਵਈ ਪੱਗ ਕਿਉਂਕਿ ਇਹ ਪੱਗ ਸਾਡੇ ਦਾਦੇ ਪੜਦਾਦਿਆਂ ਵੱਲੋਂ ਪੀੜ੍ਹੀ ਦਰ ਪੀੜ੍ਹੀ ਹਾਲੇ ਤੱਕ ਚੱਲਦੀ ਆ ਰਹੀ ਹੈ